ਮੌਜੂਦਾ ਦ੍ਰਿਸ਼ ਦੇ ਵਿੱਚ ਵਿਗਿਆਪਨ ਅਤੇ ਵਧੇਰੇ ਲੋਕਾਂ ਤੱਕ ਪਹੁੰਚਣ ਦੇ ਕੁਝ ਤਰੀਕੇ ਹਨ ਜਿਵੇਂ ਕਿ ਅਸੀਂ ਉਹਨਾਂ ਦੇ ਬਾਰੇ ਸੁਣ ਕੇ ਅਸੀਂ ਉਹਨਾਂ ਦੇ ਪਤਾ ਕਰ ਪਤਾ ਘਰ ਦੇ ਪਤਾ ਪਤਾ ਕਰਕੇ ਉਹਨਾਂ ਤੱਕ ਪਹੁੰਚ ਜਾਂਦੇ ਹਨ ਕੁਛ ਇਸ਼ਤਿਹਾਰ ਛਪਵਾ ਦਿੱਤਾ ਜਾਂਦੇ ਹਨ ਤਾਂ ਜੋ ਅਸੀਂ ਉਹਨਾਂ ਤੱਕ ਪਹੁੰਚ ਸਕੀਏ